ਮੇਰੇ ਲਈ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਅਤੇ ਮਹੱਤਵਪੂਰਨ ਚੀਜ਼ ਮੇਰੇ ਲਈ ਮਾਂ ਬਾਪ ਹੈ ਮੇਰੇ ਮਾਂ ਬਾਪ ਮੇਰੇ ਲਈ ਇੱਕ ਅਨਮੋਲ ਧਨ ਅਤੇ ਮੈਂ ਉਹਨਾਂ ਦੀ ਕਦਰ ਬਹੁਤ ਵੱਧ ਤੋਂ ਵੱਧ ਕਰਦਾ ਹਾਂ ਉਹਨਾਂ ਨੇ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਹੀ ਮੇਰਾ ਸਾਥ ਦਿੱਤਾ ਹੈ ਮੇਰੇ ਸੁਪਨੇ ਨੂੰ ਸਮਰਥ ਕੀਤਾ ਹੈ ਅਤੇ ਮੇਰੇ ਹਰ ਕਦਮ 'ਤੇ ਮੇਰਾ ਸਾਥ ਦਿੱਤਾ ਹੈ ਮੇਰੇ ਮਾਂ ਬਾਪ ਨੇ ਮੇਰੇ ਵਿੱਚ ਇਥੇ ਤਰੱਕੀ ਸਮਝ ਅਤੇ ਸੱਚਾਈ ਦੀ ਬੁਨਿਆਦੀ ਰੱਖੀ ਹੈ ਉਹਨਾਂ ਨੇ ਮੇਰੇ ਲਈ ਮਿਹਨਤ ਦਾ ਮੇਅਰ ਸੈੱਟ ਕੀਤਾ ਹੈ ਅਤੇ ਮੈਂ ਉਹਨਾਂ ਦੀ ਕਿਰਪਾ ਨਾਲ ਅੱਜ ਵੀ ਸਭ ਕੁਝ ਹਾਸਿਲ ਕੀਤਾ ਹੈ ਉਹਨਾਂ ਦੀ ਕਦਰ ਕਰਨਾ ਮੇਰੇ ਲਈ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਪਿਆਰ ਅਤੇ ਸਾਥ ਮੇਰੇ ਹਰ ਕਦਮ 'ਤੇ ਮੈਨੂੰ ਸ਼ਕਤੀ ਅਤੇ ਹਿੰਮਤ ਦਿੰਦਾ ਹੈ ਮੇਰੇ ਮਾਂ ਬਾਪ ਨੇ ਮੇਰੇ ਵਿੱਚ ਇੱਥੇ ਸਮਝ ਸੇਵਾ ਅਤੇ ਸੰਸਕਾਰ ਦੀਆਂ ਹਾਂ ਜਿਨ੍ਹਾਂ ਦੀ ਕਦਰ ਦੀ ਲੋੜ ਮੇਰੀ ਜ਼ਿੰਦਗੀ ਦੇ ਹਰ ਮੋੜ 'ਤੇ ਹੁੰਦੀ ਹੈ ਉਹਨਾਂ ਨੇ ਮੇਰੇ ਨੂੰ ਇੱਥੇ ਸ਼ਿਕਸ਼ਾ ਦੀ ਮੇਰੇ ਮਨ ਅਤੇ ਆਤਮਾ ਨੂੰ ਵਿਕਸਿਤ ਕੀਤਾ ਹੈ ਅਤੇ ਮੇਰੇ ਸੋਚ ਵਿੱਚ ਸੱਚਾਈ ਅਤੇ ਇਮਾਨਦਾਰੀ ਦਾ ਰਸਤਾ ਦਿਖਾਇਆ ਹੈ ਅਸੀਂ ਅਕਸਰ ਜ਼ਿੰਦਗੀ ਵਿੱਚ ਬਿਜ਼ੀ ਹੋ ਜਾਂਦੇ ਹਾਂ ਤੇ ਆਪਣੇ ਮਾਂ ਬਾਪ ਦੀ ਕਦਰ ਨੂੰ ਭੁੱਲ ਜਾਂਦੇ ਹਾਂ ਪਰ ਮੇਰੇ ਲਈ ਉਹਨਾਂ ਦੀ ਯਾਦ ਅਕਸਰ ਮੇਰੇ ਦਿਲ ਨੂੰ ਛੂਹ ਜਾਂਦੀ ਹੈ ਮੇਰੇ ਮਾਂ ਬਾਪ ਮੇਰੇ ਲਈ ਨਹੀਂ ਸਿਰਫ਼ ਮੇਰਾ ਸਾਥ ਦੇਤੇ ਹੈ ਬਲਕਿ ਉਹ ਮੇਰੇ ਮਟਿਓਰਸ ਹੈ ਮੰਟਿਓਰਸ